ਹੈਲੋ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਜੀ ਤੁਸੀਂ ਪਵਨ ਕਲੱਬ ਦੇ ਇੰਚਾਰਜ ਬੋਲ ਰਹੇ ਹੋ ਹਾਂਜੀ ਠੀਕ ਹੈ ਜੀ ਮੈਂ ਇੱਥੇ ਕਪੂਰਥਲਾ ਦੇ ਵਿੱਚ ਰਹਿੰਦੀ ਹਾਂ ਅਤੇ ਮਤਲਬ ਮੇਰਾ ਨਾਮ ਏਕਤਾ ਹੈ ਅਤੇ ਮੈਂ ਆਪਣੇ ਬੱਚੇ ਲਈ ਇੱਥੇ ਅਡਮਿਸ਼ਨ ਕਰਵਾਉਣੀ ਸੀ ਇਸ ਕਰਕੇ ਮੈਂ ਮਤਲਬ ਇਨਕੁਆਰੀ ਲਈ ਕੋਲ ਕੀਤਾ ਸੀ ਕੀ ਕੀ ਐਕਟੀਵਿਟੀਜ਼ ਹਨ ਤੁਹਾਡੇ ਕੋਲ ਜਿੱਦਾਂ ਤੁਹਾਨੂੰ ਪਤਾ ਹੁਣ ਅੱਜ ਕੱਲ ਬੱਚਿਆਂ ਨੂੰ ਸਮਰ ਵੀਕੇਸ਼ਨ ਦੀਆਂ ਛੁੱਟੀਆਂ ਪੈ ਰਹੀਆਂ ਗਰਮੀਆਂ ਦੀਆਂ ਹੈ ਨਾ ਅਤੇ ਬੱਚੇ ਸਾਰਾ ਦਿਨ ਘਰ ਸ਼ਰਾਰਤਾਂ ਕਰਦੇ ਹਨ ਹੈ ਨਾ ਮਤਲਬ ਪੜ੍ਹਾਈ ਵੀ ਤਾਂ ਪੂਰਾ ਦਿਨ ਨਹੀਂ ਕਰ ਪਾਉਂਦੇ ਇਸ ਕਰਕੇ ਮੈਂ ਸੋਚਿਆ ਆਪਣੇ ਬੱਚੇ ਦੀ ਐਕਟੀਵਿਟੀਜ਼ ਦੇ ਵਿੱਚ ਅਡਮਿਸ਼ਨ ਕਰਵਾ ਦਵਾਂ ਕੀ ਐਕਟੀਵਿਟੀਜ਼ ਹਨ ਮੈਮ ਤੁਹਾਡੇ ਕੋਲ ਇੱਥੇ ਮੈਮ ਮੇਰਾ ਬੱਚਾ ਹੈਗਾ ਏ ਆ ਪੰਦਰਾਂ ਸਾਲ ਦਾ ਹਾਂਜੀ ਬੋਆਏ ਹੈ ਹਾਂਜੀ ਮੁੰਡਾ ਆ ਮੁੰਡਾ ਆ ਹਾਂਜੀ ਅਤੇ ਤੁਹਾਨੂੰ ਤੁਸੀਂ ਮੈਨੂੰ ਮਤਲਬ ਪੂਰੇ ਜੈਂਡਰ ਦੇ ਅਕੋਰਡਿੰਗ ਤਾਂ ਲਾਈਕ ਹੈ ਨਾ ਉਹਨਾਂ ਦੀ ਏਜ ਦੇ ਅਕੋਰਡਿੰਗ ਤੁਸੀਂ ਕੀ ਕੀ ਐਕਟੀਵਿਟੀਜ਼ ਉਦਾਂ ਦੇ ਰਹੋ ਹੋ ਮੈਨੂੰ ਪੂਰਾ ਦੱਸ ਦਿਓ ਮੈਮ ਤੁਸੀਂ ਓਕੇ ਓਕੇ ਓਕੇ ਹਾਂਜੀ ਹਾਂਜੀ ਹਾਂਜੀ ਓਕੇ ਓਕੇ ਹਾਂਜੀ ਮੈਡਮ ਟੇਬਲ ਟੈਨਿਸ ਵੀ ਵਧੀਆ ਖੇਡ ਲੈਂਦਾ ਹੈ ਉਹ ਅਤੇ ਬਾਕੀ ਮੈਂ ਕੁਛ ਡਿਫਰੈਂਟ ਚਾਹੁੰਦੀ ਸੀ ਬਾਕੀ ਕੋਈ ਗੱਲ ਨਹੀਂ ਮੈਂ ਬੱਚੇ ਨੂੰ ਲੈ ਕੇ ਆਵਾਂਗੀ ਅਤੇ ਬਟ ਤੁਸੀਂ ਇਹਨਾਂ ਦਾ ਫੀਸ ਸਟਰਕਚਰ ਵੀ ਦੱਸ ਸਕਦੇ ਹੋ ਕੀ ਇਹਨਾਂ ਦਾ ਫੀਸ ਸਟਰਕਚਰ ਕਿੱਦਾਂ ਦਾ ਡਿਫਰੈਂਟ ਡਿਫਰੈਂਟ ਹੈ ਹਾਂਜੀ ਹਾਂਜੀ ਹਾਂਜੀ ਓਕੇ ਓਕੇ ਓਕੇ ਮੈਡਮ ਓਕੇ ਠੀਕ ਆ ਮੈਮ ਠੀਕ ਆ ਹਾਂਜੀ ਓਕੇ ਮੈਡਮ ਫੀਸ ਤਾਂ ਵਾਜਿਬ ਹੈ ਕੋਈ ਗੱਲ ਨਹੀਂ ਠੀਕ ਹੈ ਮੈਂ ਬੱਚੇ ਨੂੰ ਲੈ ਕੇ ਜ਼ਰੂਰ ਆਵਾਂਗੀ ਤੁਹਾਡੇ ਕੋਲ ਅਤੇ ਟਾਈਮਿੰਗ ਵਗੈਰਾ ਕਿੱਦਾਂ ਮੈਡਮ ਇਹਨਾਂ ਦੀ ਟਾਈਮਿੰਗ ਵਗੈਰਾ ਕਿੱਦਾਂ ਰੱਖੀ ਹੈ ਤੁਸੀਂ ਮਤਲਬ ਦੋ ਘੰਟੇ ਲਈ ਹੈ ਅਤੇ ਦੋ ਘੰਟੇ ਦੇ ਵਿੱਚ ਪ੍ਰੋਪਰ ਸਿਖਲਾਈ ਦਿੱਤੀ ਜਾਂਦੀ ਹੈ ਫਿਰ ਬੱਚੇ ਨੂੰ ਓਕੇ ਠੀਕ ਹੈ ਜੀ ਹਾਂਜੀ ਕੋਈ ਗੱਲ ਨਹੀਂ ਮੈਡਮ ਮੈਂ ਹਾਂਜੀ ਜ਼ਰੂਰ ਬੱਚੇ ਨੂੰ ਲੈ ਕੇ ਆਵਾਂਗੀ ਨਾਲੇ ਦੇਖ ਲਏਗਾ ਨਾਲੇ ਬੱਚੇ ਦੀ ਚੋਇਸ ਹੋ ਜਾਏਗੀ ਠੀਕ ਹੈ ਓਕੇ ਮੈਡਮ ਬਾਏ ਬਾਏ